ਹਾਂਜੀ ਮੇਰੇ ਕੋਲ ਪੁਰਾਣੀ ਫੋਟੋਆਂ ਦੀ ਹਾਰਡ ਕਾਪੀ ਪਈ ਹੈ ਅਤੇ ਪੁਰਾਣੇ ਸਮੇਂ ਦੇ ਵਿੱਚ ਹਾਰਡ ਕਾਪੀ ਹੀ ਜ਼ਿਆਦਾਤਰ ਮਨਾਈ ਜਾਂਦੀ ਸੀ ਕਿਸੇ ਕੋਲ ਵੀ ਡਿਜੀਟਲ ਫੋਟੋਆਂ ਦਾ ਕੋਈ ਉਹਨਾਂ ਕੋਲ ਨਹੀਂ ਹੁੰਦਾ ਸੀ ਤਰੀਕਾ ਕਿ ਉਹ ਡਿਜੀਟਲ ਫੋਟੋਆਂ ਲੈ ਸਕਣ ਅਤੇ ਮੇਰੇ ਇਹ ਖਿਆਲ ਨੇ ਕਿ ਪੁਰਾਣੀ ਅਤੇ ਨਵੇਂ ਡਿਜੀਟਲ ਫੋਟੋਆਂ ਬਾਰੇ ਕਿ ਜੋ ਪ੍ਰਾਣੀ ਹਾਰਡ ਕਾਪੀ ਵਾਲੀ ਫੋਟੋਆਂ ਸੁਣਦੇ ਹਾਂ ਅਸੀਂ ਉਹਦੇ 'ਚ ਭਾਵਨਾਤਮਕ ਮੁੱਲ ਬਹੁਤ ਹੀ ਜ਼ਿਆਦਾ ਹੁੰਦੇ ਸੀ ਕਿਉਂਕਿ ਕੋਈ ਵੀ ਵਿਅਕਤੀ ਜਦ ਕਿਸੇ ਵੀ ਸਮੇਂ ਉਹ ਉਸ ਫੋਟੋ ਨੂੰ ਲੈ ਨਹੀਂ ਸਕਦਾ ਸੀ ਉਹਨੂੰ ਲੈਣ ਲਈ ਪ੍ਰੋਪਰ ਇੱਕ ਵੱਡਾ ਕੈਮਰਾ ਚਾਹੀਦਾ ਹੁੰਦਾ ਸੀ ਜਿਹਦੇ ਜਿਹਨੂੰ ਕਲਿੱਕ ਕਰਨ ਵਾਸਤੇ ਵੀ ਫੋਟੋਗ੍ਰਾਫਰ ਦੀ ਲੋੜ ਪੈਂਦੀ ਸੀ ਤਾਂ ਕਰਕੇ ਉਹ ਇਕ ਬਹੁਤ ਹੀ ਕਠਿਨ ਕੰਮ ਹੋ ਜਾਂਦਾ ਸੀ ਇੱਕ ਆਮ ਵਿਅਕਤੀ ਲਈ ਅਤੇ ਕੈਮਰੇ ਉਸ ਸਮੇਂ ਬਹੁਤ ਹੀ ਮਹਿੰਗੇ ਆਉਂਦੇ ਸੀ ਹਰ ਇੱਕ ਵਿਅਕਤੀ ਉਸ ਕੈਮਰੇ ਨੂੰ ਖਰੀਦ ਨਹੀਂ ਸਕਦਾ ਸੀ ਅਗਰ ਉਹ ਖਰੀਦ ਵੀ ਸਕਦਾ ਸੀ ਅਤੇ ਫੋਟੋ ਖਿੱਚਣ ਤੋਂ ਬਾਅਦ ਉਹਨੂੰ ਵੇਖ ਨਹੀਂ ਸਕਦਾ ਸੀ ਉਹਨੂੰ ਵੇਖਣ ਲਈ ਉਹਨੂੰ ਫੋਟੋ ਸਟੂਡੀਓ ਜਾਣਾ ਪੈਂਦਾ ਸੀ ਜਿੱਥੇ ਜਾ ਕੇ ਉਹਨੂੰ ਇੱਕ ਦੋ ਦਿਨ ਲੱਗਦੇ ਸੀ ਫੋਟੋਗ੍ਰਾਫਰ ਜੋ ਵੀ ਉਥੇ ਹੁੰਦਾ ਸੀ ਦੁਕਾਨ 'ਤੇ ਸਟੂਡੀਓ 'ਤੇ ਕੰਮ ਕਰਨ ਵਾਲਾ ਵਿਅਕਤੀ ਉਹ ਫੋਟੋਆਂ ਨੂੰ ਤਿਆਰ ਕਰਦਾ ਸੀ ਅਤੇ ਉਹਨੂੰ ਹਾਰਡ ਕੋਪੀ ਅੰਦਰ ਬਣਾ ਕੇ ਅਤੇ ਫਿਰ ਉਹ ਜਿਸ ਨੂੰ ਵੀ ਚਾਹੀਦੀ ਹੁੰਦੀ ਸੀ ਉਸਨੂੰ ਪ੍ਰੋਵਾਈਡ ਕਰਦਾ ਸੀ ਅਤੇ ਉਹਨੂੰ ਦਿੰਦਾ ਸੀ ਤਾਂ ਕਰਕੇ ਇਹ ਇੱਕ ਬਹੁਤ ਹੀ ਖਾਸ ਮੌਕੇ 'ਤੇ ਲਿੱਤੀ ਜਾਂਦੀਆਂ ਸੀ ਹਾਰਡ ਕੋਪੀ ਦੀ ਜਿਵੇਂ ਫੋਟੋਆਂ ਤਾਂ ਕਰਕੇ ਇਸ ਹਾਰਡ ਕੋਪੀ ਵਾਲੀ ਫੋਟੋਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਭਾਵਨਾਤਮਕ ਮੁੱਲ ਜੁੜੇ ਹੋਏ ਹਨ ਕਿਉਂਕਿ ਇਸ ਦੇ ਵਿੱਚ ਸਾਡੀ ਪੁਰਾਣੀ ਸਾਰੀ ਯਾਦਾਂ ਹੁੰਦੀਆਂ ਹਨ ਇਸ ਨੂੰ ਜਲਦੀ ਖਤਮ ਨਹੀਂ ਕੀਤਾ ਜਾ ਸਕਦਾ ਇਹ ਸਾਡੀ ਐਲਬਮ ਦੇ ਵਿੱਚ ਅਸੀਂ ਰੱਖਦੇ ਹਾਂ ਪਰ ਜੋ ਅੱਜ ਦਾ ਸਮਾਂ ਆ ਗਿਆ ਹੈ ਉਸ ਸਮੇਂ ਦੇ ਵਿੱਚ ਅਸੀਂ ਫੋਨ ਨਾਲ ਫੋਟੋ ਡਿਜੀਟਲ ਫੋਟੋਆਂ ਜਿਸ ਨੂੰ ਕਹਿੰਦੇ ਹਾਂ ਉਹ ਅਸੀਂ ਕਦੋਂ ਕਦੇ ਵੀ ਕਲਿੱਕ ਕਰ ਸਕਦੇ ਹਾਂ ਉਹਦੇ ਵਿੱਚ ਭਾਵਨਾਤਮਕ ਮੁੱਲ ਨਹੀਂ ਹੁੰਦੇ ਅਸੀਂ ਕਿਉਂਕਿ ਉਹਦੇ ਵਿੱਚ ਕਲਿੱਕ ਕਰਕੇ ਨਾਲੋ ਨਾਲ ਵੇਖ ਸਕਦੇ ਹਾਂ ਅਤੇ ਨਾਲੋਂ ਨਾਲ ਹੀ ਅਸੀਂ ਡਿਲੀਟ ਕਰ ਸਕਦੇ ਹਾਂ ਜਿਸ ਦੇ ਕਾਰਨ ਉਹਨਾਂ ਦੇ ਭਾਵਨਾਤਮਕ ਮੁੱਲ ਬਹੁਤ ਹੀ ਘੱਟ ਜਾਂਦੇ ਹਨ ਇਸ ਲਈ ਪੁਰਾਣੇ ਸਮੇਂ ਦੀ ਜਿਹੜੀ ਫੋਟੋਆਂ ਹੁੰਦੀਆਂ ਸੀ ਉਹਦੇ ਵਿੱਚ ਭਾਵਨਾਤਮਕ ਮੁੱਲ ਬਹੁਤ ਹੀ ਜ਼ਿਆਦਾ ਹੁੰਦੇ ਸੀ ਇਸ ਲਈ ਮੇਰਾ ਵੀ ਇਹੀ ਖਿਆਲ ਹੈ ਕਿ ਪੁਰਾਣੀ ਫੋਟੋਆਂ ਜਿਹੜੀ ਹਾਰਡ ਕਾਪੀ ਵਾਲੀ ਫੋਟੋਆਂ ਹੁੰਦੀਆਂ ਸੀ ਉਹਦੇ ਵਿੱਚ ਭਾਵਨਾਤਮਕ ਮੁੱਲ ਬਹੁਤ ਹੀ ਜ਼ਿਆਦਾ ਹੁੰਦੇ ਸੀ ਅ ਅਗਰ ਅਸੀਂ ਡਿਜੀਟਲ ਫੋਟੋਆਂ ਦੇ ਮੁਕਾਬਲੇ ਵੇਖੀਏ ਤਾਂ